ਆਮ ਤੌਰ 'ਤੇ ਪੰਜਾਬ ਖੇਤੀਬਾੜੀ ਦਾ ਰਾਜ ਮੰਨਿਆ ਜਾਂਦਾ ਹੈ ਅਤੇ ਇਹ ਆਪਣੀ ਖੇਤੀਬਾੜੀ ਕਰਕੇ ਹੀ ਮਸ਼ਹੂਰ ਹੈ ਪੰਜਾਬ ਦੇ ਵਿੱਚ ਕਣਕ ਮੱਕੀ ਚੌਲ ਆਦਿ ਸਮਾਨ ਦੀ ਖੇਤੀ ਕੀਤੀ ਜਾਂਦੀ ਹੈ ਪਰੰਤੂ ਪੰਜਾਬ ਦੇ ਵਿੱਚ ਅਜਿਹੀਆਂ ਕਈ ਇੰਡਸਟਰੀਆਂ ਹਨ ਜਿਹੜੀ ਕਿ ਬਿਜਨਸ ਵਜੋਂ ਕੰਮ ਕਰਦੀਆਂ ਹਨ ਜਿਵੇਂ ਕੱਪੜਾ ਉਦਯੋਗ ਖੰਡ ਉਦਯੋਗ ਕੋਟਨ ਇੰਡਸਟਰੀ ਆਦਿ ਪੰਜਾਬ ਵਿੱਚ ਚਲਾਈ ਜਾਣ ਵਾਲੀਆਂ ਇੰਡਸਟਰੀਆਂ ਹਨ ਪੰਜਾਬ ਵਿੱਚ ਕਿਸੇ ਵੀ ਕਾਰੋਬਾਰ ਨੂੰ ਨੈਵੀਗੇਟ ਕਰਨ ਲਈ ਸਭ ਤੋਂ ਪਹਿਲਾਂ ਉਹਦੇ ਉਹਦੇ ਨਿਯਮ ਅਤੇ ਕਾਨੂੰਨਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਪੰਜਾਬ ਵਿੱਚ ਜਦੋਂ ਵੀ ਕੋਈ ਅ ਕੰਮ ਚਲਾਇਆ ਜਾਂਦਾ ਹੈ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਲਗਾਇਆ ਜਾਂਦਾ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਇਹ ਚੀਜ਼ ਦੇਖਦੇ ਹਾਂ ਕਿ ਅਸੀਂ ਕਾਨੂੰਨ ਅਤੇ ਨਿਯਮਾਂ ਦੀ ਪਾਲਣਾ ਕਰ ਰਹੇ ਹਾਂ ਜਾਂ ਨਹੀਂ ਸਭ ਤੋਂ ਪਹਿਲਾਂ ਅਸੀਂ ਸਰਕਾਰ ਰਾਹੀਂ ਅਤੇ ਕਿਸੇ ਵੀ ਉਦਯੋਗ ਨੂੰ ਚਲਾਉਣ ਲਈ ਉੱਥੋਂ ਦੀ ਸਰਕਾਰ ਅਤੇ ਉੱਥੋਂ ਦੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਪਰਮੀਸ਼ਨ ਅਤੇ ਉਹਨਾਂ ਦੀ ਆਗਿਆ ਲੈਣਾ ਜ਼ਰੂਰੀ ਸਮਝਦੇ ਹਨ ਇਸ ਤੋਂ ਬਾਅਦ ਅਸੀਂ ਉਸ ਇੰਡਸਟਰੀ ਵਿੱਚ ਖਪਾਈਆਂ ਜਾਣ ਵਾਲੀਆਂ ਪੈਸਿਆਂ ਦਾ ਅੱਧਾ ਹਿੱਸਾ ਸਰਕਾਰ ਨੂੰ ਟੈਕਸ ਵਜੋਂ ਪੇ ਕਰਦੇ ਹਨ ਤਾਂ ਜੋ ਸਰਕਾਰ ਉਸ ਪੈਸੇ ਨੂੰ ਸਾਡੇ ਲਈ ਹੀ ਸਾਡੇ ਦੁਆਰਾ ਹੀ ਸਾਡੇ ਵਿਕਾਸ ਲਈ ਵਰਤ ਸਕੇ ਅਤੇ ਉਹ ਇਹ ਪੈਸੇ ਰਾਹੀਂ ਸਾਡੇ ਪੰਜਾਬ ਦੀ ਵਿਕਾਸ ਵਿੱਚ ਹਿੱਸਾ ਪਾ ਸਕਣ ਇਹ ਜਿਹੀਆਂ ਹੋਰ ਬਹੁਤ ਸਾਰੀਆਂ ਉਦਾਹਰਨਾਂ ਹਨ ਜਿਹੜੀ ਕੀ ਪੰਜਾਬ ਵਜੋਂ ਅਤੇ ਪੰਜਾਬ ਦੀ ਉਦਯੋਗ ਵਜੋਂ ਕੀਤੀਆਂ ਜਾਂਦੀਆਂ ਹਨ ਜਿਵੇਂ ਲੁਧਿਆਣੇ ਦੀ ਕੋਟਨ ਇੰਡਸਟਰੀ ਬਹੁਤ ਹੀ ਫੇਮਸ ਹੈ ਅਤੇ ਲੁਧਿਆਣੇ ਵਿੱਚ ਕੱਪੜਾ ਇੰਡਸਟਰੀ ਵੀ ਚਲਾਈ ਜਾਂਦੀ ਹੈ ਇਹ ਇੰਡਸਟਰੀਜ਼ ਇਹ ਇੰਡਸਟਰੀਜ਼ ਖ਼ਾਸ ਕਰ ਨਿਯਮਾਂ ਦੀ ਪਾਲਣਾ ਅਤੇ ਕਾਨੂੰਨ ਦੀ ਦੇਖ ਰੇਖ ਰਾਹੀਂ ਹੀ ਕੰਮ ਕਰਦੀ ਹੈ